ਛੇ ਜੂਨ ਉੱਨੀ ਸੌ ਚੁਰਾਸੀ ਦਸ ਮਈ ਉੱਨੀ ਸੌ ਛਿਆਹਠ ਦਸ ਦਸੰਬਰ ਦੋ ਹਜ਼ਾਰ ਇੱਕ ਤੇਰ੍ਹਾਂ ਜੁਲਾਈ ਦੋ ਹਜ਼ਾਰ ਚੌਦ੍ਹਾਂ ਨਵੰਬਰ ਦੋ ਹਜ਼ਾਰ ਦੋ